ਮੇਰੀ ਸਬਜ਼ੀ ਮੰਡੀ ਵਿੱਚ ਫਲ ਅਤੇ ਸਬਜ਼ੀ ਦੀ ਆੜ੍ਹਤ ਦੀ ਦੁਕਾਨ ਹੈ ਮੈਂ ਰੋਜ਼ ਦਾ ਆਪਣੇ ਸਬਜ਼ੀ ਅਤੇ ਫਲ ਦੀ ਵੇਚ ਦਾ ਸਾਰਾ ਜਮ੍ਹਾਂ ਵੇਚ ਖਾਤਾ ਸ਼ਾਮ ਨੂੰ ਆਪਦੀਆਂ ਕਿਤਾਬਾਂ ਦੇ ਉੱਤੇ ਲਿਖਦਾ ਹੁੰਦਾ ਸੀ ਜਿਸ ਦੇ ਨਾਲ ਮੈਨੂੰ ਪਤਾ ਰਹਿੰਦਾ ਸੀ ਕਿ ਮੈਂ ਕਿਸ ਨੂੰ ਕਿੰਨੇ ਪੈਸਿਆਂ ਦੀ ਸਬਜ਼ੀ ਉਧਾਰ ਦਿੱਤੀ ਹੈ ਅਤੇ ਕੀ ਕੀ ਸਮਾਨ ਨਕਦ ਵੇਚਿਆ ਹੈ ਇਸ ਨਾਲ ਮੈਨੂੰ ਆਪਣੇ ਵਪਾਰ ਵਿੱਚ ਲਾਭ ਦਾ ਪਤਾ ਚੱਲਦਾ ਰਹਿੰਦਾ ਸੀ ਪਰ ਹੁਣ ਜਦੋਂ ਦਾ ਕੰਪਿਊਟਰ ਦਾ ਜ਼ਮਾਨਾ ਆਇਆ ਹੈ ਮੈਂ ਆਪਣੇ ਰੋਜ਼ ਦੇ ਵੇਚ ਅਤੇ ਖਰੀਦ ਦੇ ਸਾਰੀਆਂ ਆਈਟਮਾਂ ਦੀ ਗਿਣਤੀ ਨੂੰ ਆਪਦੇ ਕੰਪਿਊਟਰ ਦੇ ਉੱਤੇ ਨੋਟ ਕਰ ਦਿੰਦਾ ਹਾਂ ਜਿਸ ਨਾਲ ਮੈਨੂੰ ਹੁਣ ਦੀ ਨਵੀਂ ਟੈਕਨੋਲੋਜੀ ਨਾਲ ਬਹੁਤ ਹੀ ਸੁਖਾਲਾ ਕੰਮ ਹੋ ਗਿਆ ਹੈ ਇਸ ਕਰਕੇ ਮੈਨੂੰ ਬਹੁਤਾ ਖਪਣਾ ਨਹੀਂ ਪੈਂਦਾ ਲਿਖਣਾ ਨਹੀਂ ਪੈਂਦਾ ਕਿਸੇ ਦੇ ਨਾਮ ਆਪਦੇ ਦਿਮਾਗ ਦੇ ਵਿੱਚ ਯਾਦ ਨਹੀਂ ਰੱਖਣੇ ਪੈਂਦੇ ਮੈਂ ਸਭ ਬੰਦਿਆਂ ਦਾ ਅਲੱਗ ਅਲੱਗ ਇੱਕ ਫੋਲਡਰ ਬਣਾਇਆ ਹੋਇਆ ਹੈ ਜਿਸ ਨਾਲ ਮੈਂ ਹਰ ਕਿਸੇ ਦੀ ਅਲੱਗ ਅਲੱਗ ਖਾਤੇ ਚੜ੍ਹਾ ਦਿੰਦਾ ਹਾਂ ਇਸ ਨਵੀਂ ਟੈਕਨੋਲਜੀ 'ਤੇ ਮੈਨੂੰ ਪੂਰਾ ਭਰੋਸਾ ਹੈ ਕਿਉਂਕਿ ਅੱਗੇ ਕਦੇ ਮੈਨੂੰ ਕਿਤਾਬਾਂ ਦੇ ਗੁੰਮ ਹੋ ਜਾਣ ਦਾ ਜਾਂ ਚੋਰੀ ਹੋ ਜਾਣ ਦਾ ਡਰ ਰਹਿੰਦਾ ਸੀ ਪਰ ਨਵੀਂ ਤਕਨੀਕੀ ਟੈਕਨੋਲੋਜੀ ਦੇ ਨਾਲ ਮੇਰਾ ਸਾਰਾ ਵਹੀ ਖਾਤਾ ਕੰਪਿਊਟਰ ਦੇ ਵਿੱਚ ਸਟੋਰ ਜਮ੍ਹਾਂ ਰਹਿੰਦਾ ਹੈ ਜਿਸ ਨਾਲ ਮੈਂ ਇਸ ਖਾਤੇ ਨੂੰ ਕਿਸੇ ਹੋਰ ਜਗ੍ਹਾ 'ਤੇ ਵੀ ਖੋਲ੍ਹ ਕੇ ਵੇਖ ਸਕਦਾ ਹਾਂ